ਹੈਲੋ ਹਾਂਜੀ ਕੌਣ ਬੋਲ ਰਿਹਾ ਅੱਛਾ ਜੀ ਅਸੀਂ ਜਗਬਾਣੀ ਤੋਂ ਬੋਲ ਰਹੇ ਹੈ ਜੀ ਸਿਮਰਨ ਕੌਰ ਬੋਲਦੀ ਜੀ ਹਾਂਜੀ ਤੁਹਾਡੇ ਤੋਂ ਅਸੀਂ ਇਹਨਾਂ ਦਾ ਹੜਾਂ ਦੇ ਬਾਰੇ ਪੁੱਛਦੇ ਹਾਂ ਹਾਂਜੀ ਹਾਂਜੀ ਹਾਂਜੀ ਹਾਂਜੀ ਇੱਧਰ ਜ਼ਿਆਦਾ ਹੀ ਨੁਕਸਾਨ ਹੋ ਗਿਆ ਜੀ ਸਾਰਿਆਂ ਫਸਲਾਂ ਫਸਲਾਂ ਵਗੈਰਾ ਦਾ ਅੱਛਾ ਅੱਛਾ

ਹਾਂਜੀ ਹਾਂਜੀ ਅਤੇ ਫਸਲਾਂ ਦਾ ਵੀ ਬਹੁਤ ਜ਼ਿਆਦਾ ਨੁਕਸਾਨ ਹੋਇਆ ਕਿਸਾਨ ਬਹੁਤ ਜ਼ਿਆਦਾ ਪਰੇਸ਼ਾਨ ਹੋ ਗਏ ਅਤੇ ਹੁਣ ਇਹ ਸਰਕਾਰ ਪਤਾ ਨਹੀਂ ਕੀ ਕਰੇਗੀ ਅੱਗੇ ਜਾ ਕੇ

ਹਾਂ ਹਾਂਜੀ ਹਾਂਜੀ ਅਤੇ ਵਿਚਾਰੇ ਨੇ ਖਾਣ ਪੀਣ ਦਾ ਸਮਾਨ ਕਿਵੇਂ ਪਹੁੰਚਾਇਆ ਲੋਕਾਂ ਤਾਂਈ ਹਾਂ ਹਾਂਜੀ ਅਤੇ ਲੋਕਾਂ ਨੂੰ ਘਰਾਂ ਦੇ ਘਰ ਬੇਘਰ ਹੋ ਗਏ ਲੋਕਾਂ ਨੇ ਪਾਣੀ ਆ ਛੱਤਾਂ ਡੁੱਬ ਗਈਆਂ ਕਈ ਤਾਂ ਘਰ ਪਿੰਡਾਂ ਦੇ ਪਿੰਡ ਉਹ ਪਿੰਡਾਂ ਦੇ ਤਬਾਹ ਹੋ ਕੇ ਦੂਜੀਆਂ ਜਗ੍ਹਾ ਤੋਂ ਉਹਨਾਂ ਨੂੰ ਆਪਦੇ ਘਰ ਛੱਡ ਕੇ ਕਿਤੇ ਹੋਰ ਜਗ੍ਹਾ 'ਤੇ ਜਾਣਾ ਪਿਆ ਹਾਂ ਹਾਂਜੀ ਹਮ ਅੱਛਾ ਅਤੇ ਹੋਰ ਕਿੱਦਾਂ ਇੱਧਰਲੇ ਇੱਧਰ ਪੰਜਾਬ 'ਚ ਹੋਰ ਕਿਹੜੇ ਪਾਸੇ ਹੋਰ ਮਾਲਵੇ 'ਚ ਮਾਲਵੇ 'ਚ ਜ਼ਿਆਦਾ ਨੁਕਸਾਨ ਹੋਇਆ ਹਾਂਜੀ ਠੀਕ ਹੈ ਚਲੋ